ਮੈਂ ਪ੍ਰੇਮ ਸਿੰਘ ਪਠਾਨਕੋਟ ਦਾ ਵਾਸੀ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਦੇ ਬੱਚਿਆਂ ਦਾ ਮਨੋਰੰਜਨ ਲਈ ਕਿਹੜੇ ਕਿਹੜੇ ਸਾਧਨ ਹਨ ਬੱਚਿਆਂ ਦੇ ਮਨੋਰੰਜਨ ਦੇ ਸਾਧਨ ਬੱਚਿਆਂ ਦੇ ਮਨੋਰੰਜਨ ਦੇ ਸਾਧਨ ਜੇਕਰ ਸਾਧਨਾਂ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਲਈ ਤਰ੍ਹਾਂ ਤਰ੍ਹਾਂ ਦੇ ਮਨੋਰੰਜਨ ਹੁੰਦੇ ਹਨ ਜਿਸ ਜਿਸ ਤਰ੍ਹਾਂ ਬੱਚੇ ਕੁਝ ਬੱਚੇ ਖੇਡਾਂ ਵਿੱਚ ਮਸਤ ਰਹਿੰਦ ਰਹਿ ਕੇ ਮਨੋਰੰਜਨ ਕਰਦੇ ਹਨ ਕੁਝ ਮੋਬਾਇਲ ਵਿੱਚ ਗੇਮਾਂ ਵਗੈਰ ਖੇਡਣ ਤੋਂ ਹਨ ਤਾਂ ਮਸਤ ਰਹਿੰਦੇ ਹਨ ਮਿਊਜ਼ਿਕ ਕਿਉਂਕਿ ਅੱਜ ਮੋਬਾਇਲ ਦੇ ਮੋਬਾਇਲ ਦਾ ਯੁੱਗ ਹੈ ਬੱਚੇ ਮੋਬਾਇਲ ਵਿੱਚ ਗਾਣੇ ਅਤੇ ਹੋਰ ਕਈ ਚੀਜ਼ਾਂ ਸੁਣਦੇ ਹਨ ਕਈ ਤਾਂ ਕਈ ਤਾਂ ਖਾਣਾ ਖਾਣ ਵੇਲੇ ਵੀ ਬੱਚੇ ਮੋਬਾਇਲ ਦਾ ਇਸਤੇਮਾਲ ਕਰਦੇ ਹਨ ਚੱਲਦਾ ਹੈ ਕਿ ਇਸ ਦੇ ਬਾਹਰ ਕਈ ਕਿ ਦੇਰ ਰਾਤ ਤੱਕ ਇਸ ਦੇ ਰਹਿੰਦੇ ਹਨ ਜਿਵੇਂ ਕਿ ਪਿੱਛੇ ਜਿਹੀ ਆਪਣਾ ਆਈ ਪੀ ਐਲ ਗੇਮਾਂ ਹੋ ਰਹੀਆਂ ਸਨ ਬਹੁਤ ਇੰਟਰਨੈੱਟ ਦੀ ਇਹ ਆਨੰਦ ਮਾਣਦੇ ਹਨ ਬੱਚੇ ਇਹਨੂੰ ਰਾਤ ਤੱਕ ਦੇਖ ਕੇ ਆਪਣਾ ਆਨੰਦ ਪੂਰਾ ਲੈਂਦੇ ਹਨ ਅਤੇ ਨਾਲ ਹੀ ਮੈਚ ਨੂੰ ਦੇਖ ਕੇ ਆਪ ਆ ਰਹੇ ਮਜ਼ੇ ਨੂੰ ਵੀ ਧੰਨਵਾਦ ਅੱਛਾ ਧੰਨਵਾਦ ਜੀ